ਭਾਰਤ ਇਸ ਗੱਲੋਂ ਆਪਣੇ ਆਪ ਉੱਪਰ ਮਾਣ ਕਰ ਰਿਹਾ ਹੈ ਕਿ ਭਾਰਤ ਦੇ ਵਿੱਚ ਬਹੁਤ ਸਾਰੇ ਨੌਜਵਾਨ ਬਲਕਿ ਪੂਰੇ ਵਿਸ਼ਵ ਦੇ ਵਿੱਚੋਂ ਵੀ ਸਭ ਤੋਂ ਜ਼ਿਆਦਾ ਨੌਜਵਾਨਾਂ ਦੀ ਗਿਣਤੀ ਭਾਰਤ ਵਿੱਚ ਹੀ ਹੈ ਭਾਰਤ ਵਿੱਚ ਨੌਜਵਾਨ ਉਤਸ਼ਾਹਿਤ ਹੋ ਕੇ ਉੱਚ ਸਿੱਖਿਆ ਪ੍ਰਾਪਤ ਕਰਨ ਵਿੱਚ ਲੱਗੇ ਹੋਏ ਹਨ ਉਹ ਚਾਹੁੰਦੇ ਹਨ ਕਿ ਉੱਚ ਸਿੱਖਿਆ ਪ੍ਰਾਪਤ ਕਰਕੇ ਜਲਦੀ ਸਰਕਾਰੀ ਨੌਕਰੀ ਪ੍ਰਾਪਤ ਕਰਨ ਅਤੇ ਜਾਂ ਪ੍ਰਾਈਵੇਟ ਕਿਸੇ ਵੀ ਸੰਸਥਾ ਵਿੱਚ ਰੁਜ਼ਗਾਰ ਪ੍ਰਾਪਤ ਕਰਨ ਇਸ ਲਈ ਉਹ ਨਿੱਠ ਕੇ ਪੜ ਰਹੇ ਹਨ ਮਿਹਨਤ ਕਰ ਰਹੇ ਹਨ ਪਰ ਭਾਰਤ ਦੇ ਵਿੱਚ ਨੌਕਰੀਆਂ ਦਾ ਹਾਲ ਬੜਾ ਮੰਦਾ ਹੈ ਨੌਕਰੀਆਂ ਨੌਜਵਾਨਾਂ ਨੂੰ ਮਿਲ ਨਹੀਂ ਰਹੀਆਂ ਸਰਕਾਰਾਂ ਵੀ ਕੋਈ ਨੌਕਰੀਆਂ ਦੇਣ ਲਈ ਪੁਖਤਾ ਹੱਲ ਨਹੀਂ ਦੇ ਰਹੀਆਂ ਨਾ ਹੀ ਸਰਕਾਰਾਂ ਇਸ ਵੱਲ ਧਿਆਨ ਦੇ ਰਹੀਆਂ ਹਨ ਨੌਜਵਾਨਾਂ ਨੂੰ ਲਗਾਤਾਰ ਇਸ ਪਾਸਿਓ ਬੇਰੁਖੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਰਤ ਵਿੱਚ ਨੌਕਰੀ ਪ੍ਰਾਪਤ ਕਰਨਾ ਹੁਣ ਬਹੁਤ ਵੱਡੀ ਚੁਣੌਤੀ ਵਜੋਂ ਪੇਸ਼ ਹੋ ਰਿਹਾ ਹੈ